ਮੌਸਮ ਮੌਸਮ ਦੇ ਹਿਸਾਬ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਬਰਸਾਤ ਬਰਸਾਤ ਦੇ ਵਿੱਚ ਡੇਂਗੂ ਮਲੇਰੀਆ ਹੋਣ ਦੇ ਕਾਰਨ ਬਿਮਾਰ ਹੋ ਜਾਂਦੇ ਹਨ ਅਤੇ ਠੰਡ ਦੇ ਵਿੱਚ ਮੋਸਟਲੀ ਜ਼ਿਆਦਾਤਰ ਜ਼ੁਕਾਮ ਬੁਖਾਰ ਦੀ ਪ੍ਰੋਬਲਮ ਰਹਿੰਦੀ ਹੈ ਅਤੇ ਗਰਮੀਆਂ ਦੇ ਵਿੱਚ ਜ਼ਿਆਦਾ ਗਰਮੀ ਵਿੱਚ ਰਹਿਣ ਨਾਲ ਕਿਡਨੀ ਅਤੇ ਲੀਵਰ ਵਿੱਚ ਗਰਮੀ ਪੈ ਜਾਂਦੀ ਹੈ ਜਿਸ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ